ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਟੂਰਿਸਟ ਲਈ ਗੱਲ ਕਰਦੇ ਹਾਂ ਅਸੀਂ ਜਗ੍ਹਾ ਵੀ ਦਿਖ ਗੱਡੀਆਂ ਵੀ ਪ੍ਰੋਵਾਇਡ ਕਰ ਹਾਂ ਨਾਲ ਅਸੀਂ ਹਾਂਜੀ ਹਾਂਜੀ ਵਧੀਆ ਜਗ੍ਹਾ ਨੇ ਮੋਹਾਲੀ ਜੀ ਸ਼ਹਿਰ 'ਚ ਸਭ ਤੋਂ ਆਪਣਾ ਵਧੀਆ ਵਾਲਾ ਜ਼ਿਲ੍ਹਾ ਹੀ ਮੋਹਾਲੀ ਹੈ ਪੰਜਾਬ ਦਾ

ਰੈਸਟੋਰੈਂਟ ਤਾਂ ਵਾਧੂ ਨੇ ਵੀ ਆਰ ਪੰਜਾਬ ਮਾਲ ਹੋ ਗਿਆ ਬਹੁਤ ਵਧੀਆ ਹਾਂਜੀ ਉਹ ਵੀ ਉਹ ਵੀ ਹੋ ਜਾਵੇਗਾ ਵਧੀਆ ਹੋਟਲ 'ਚ ਤੁਹਾਡਾ ਜਗ੍ਹਾ ਮਿਲ ਜਾਵੇਗੀ ਰਹਿਣ ਨੂੰ ਹਾਂਜੀ ਤੁਸੀਂ ਕਿ ਤੁਸੀਂ ਇੱਕ ਵੀਕ ਲਈ ਤਾਂ ਤੁਸੀਂ ਆਉਣਾ ਵੀ ਤੁਸੀਂ ਟੋਟਲ ਬੰਦੇ ਕਿੰਨਿਆਂ ਨੇ ਆਉਣਾ ਇੱਕ ਨੇ ਆਉਣਾ ਕਿੰਨਿਆਂ ਨੇ ਆਉਣਾ ਅੱਛਾ ਅਸੀਂ ਨਾ ਪਰ ਪਰਸਨ ਦਾ ਦਸ ਹਜ਼ਾਰ ਰੁਪਈਆ ਚਾਰਜ ਕਰਦੇ ਹਾਂ ਤੁਸੀਂ ਸਾਡੀ ਗੱਡੀ ਨਾ ਮੈਂ ਗੱਲ ਦੱਸਦਾ ਮੈਂ ਅਸੀਂ ਗੱਡੀ ਵੀ ਪ੍ਰੋਵਾਇਡ ਕਰਾ ਦੇਵਾਂਗੇ ਸਾਰਾ ਤੁਹਾਨੂੰ ਮੋਹਾਲੀ ਸ਼ਹਿਰ ਘੁੰਮਾ ਦੇਵਾਂਗੇ ਵਧੀਆ ਰੈਸਟੋਰੈਂਟ ਦਾ ਖਾਣਾ ਖਵਾ ਦੇਵਾਂਗੇ ਦੋ ਦਿਨ ਦਾ ਆਪਣਾ ਟੂਰ ਪਲੈਨ ਹੋਵੇਗਾ ਦ ਦਸ ਹਜ਼ਾਰ ਰੁਪਈਆ ਪਰ ਪਰਸਨ ਚਾਰਜ ਲੱਗੇਗਾ ਹਾਂਜੀ ਸਿਸਵਾ ਡੈਮ ਦਿਖਾਵਾਂਗੇ ਤੁਹਾਨੂੰ ਮੈਂ ਦੱਸ ਰਿਹਾ ਪਰੋਪਰ ਚਾਰਜ ਸਾਡੀ ਗੱਡੀ ਹੋਏਗੀ ਨਾਲ ਰੂਮ ਹੋਏਗਾ ਤੁਹਾਡਾ ਦੋ ਦਿਨ ਟੂਰਿਸਟ ਪਲੈਨ ਹੋਵੇਗਾ ਨਾ ਨਾ ਜੀ ਅਸੀਂ ਗੱਡੀ ਪ੍ਰੋਵਾਇਡ ਕਰਵਾ ਕੇ ਦੇਵਾਂਗੇ ਠੀਕ ਹੈ ਠੀਕ ਹੈ